ਬਾਕੀ ਭਾਰਤ ਅਤੇ ਦੁਨੀਆਂ ਲਈ ਪੰਜਾਬ ਦੇ ਮੁੱਖ ਸੱਭਿਆਚਾਰਕ ਅਤੇ ਸਮਾਜਿਕ ਯੋਗਦਾਨ ਬਹੁਤ ਹਨ ਜਿਵੇਂ ਕਿ ਜਦੋਂ ਮਨੁੱਖ ਜੰਗਲਾਂ ਤੋਂ ਝੋਂਪੜੀਆਂ ਵਿੱਚ ਨਿਕਲ ਕੇ ਪੱਕੇ ਘਰਾਂ ਅਤੇ ਨਗਰਾਂ ਦਾ ਨਿਰਮਾਣ ਕਰਨ ਲੱਗਾ ਅਤੇ ਉਸਦੀਆਂ ਲੋੜਾਂ ਅਨੁਸਾਰ ਕੰਮਾਂ ਵਿੱਚ ਵੀ ਵਾਧਾ ਹੋਇਆ

ਧੰਦੇ ਦਾ ਜਾਂ ਕਿੱਤਿਆਂ ਦਾ ਵੀ ਨਿਰਮਾਣ ਹੋਇਆ ਤਾਂ ਉਸਨੂੰ ਕੰਮ ਵਿੱਚ ਵੰਡ ਕਰਨ ਦੀ ਜ਼ਰੂਰਤ ਪਈ ਜਦੋਂ ਕੋਈ ਕਾਮਾ ਸ਼੍ਰੇਣੀ ਕਿਸੇ ਲਈ ਕੰਮ ਲੰਮਾ ਸਮਾਂ ਲਗਾਤਾਰ ਕਰਦੀ ਹੈ ਜਾਂ ਫਿਰ ਉਸਦੇ ਕਿੱਤੇ ਨਾਲ ਜਾਣਿਆ ਜਾਣ ਲੱਗਦਾ ਹੈ ਇਸੀ ਪ੍ਰਕਾਰ ਪੰਜਾਬ ਵਿੱਚ ਵੀ ਲੋਕ ਕਿੱਤਿਆਂ ਦੇ ਵੱਖ ਵੱਖ ਨਾਂ ਪ੍ਰਚਲਿਤ ਹੋਏ ਉਦਾਹਰਨ ਵੱਜੋਂ ਲੱਕੜੀ ਦਾ ਕੰਮ ਉਸ ਲੱਕੜੀ ਦਾ ਕੰਮ ਕਰਨ ਵਾਲੇ ਨੂੰ ਤਰਖਾਣ ਕਿਹਾ ਜਾਂਦਾ ਹੈ ਲੋਹੇ ਦਾ ਕੰਮ ਕਰਨ ਵਾਲੇ ਨੂੰ ਲੁਹਾਰ ਅਤੇ ਉਸੀ ਤਰ੍ਹਾਂ ਹੀ ਗਹਿਣਿਆਂ ਦਾ ਕੰਮ ਕਰਨ ਵਾਲਿਆਂ ਨੂੰ ਜਿਵੇਂ ਸੋਨੇ ਚਾਂਦੀ ਆਦਿ ਦਾ ਕੰਮ ਕਰਨ ਵਾਲੇ ਨੂੰ ਸੁਨਿਆਰ ਕਿਹਾ ਜਾਂਦਾ ਹੈ ਇਸੀ ਤਰ੍ਹਾਂ ਇਹ ਕਿੱਤਿਆਂ ਦੇ ਵੱਖ ਵੱਖ ਨਾਂ ਪ੍ਰਚਲਿਤ ਹੋਏ ਅਤੇ ਦੁਨੀਆਂ ਦੇ ਕੰਮ ਕਿੱਤੇ ਧੰਦੇ ਇੱਥੋਂ ਹੀ ਸ਼ੁਰੂ ਹੋਏ ਹਨ ਜਿਸ ਕਰਕੇ ਪੰਜਾਬ ਦਾ ਪੂਰੇ ਭਾਰਤ ਦੀ ਤਰੱਕੀ ਵਿੱਚ ਵੀ ਬਹੁਤ ਹਿੱਸਾ ਹੈ